ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਅਮਨਦੀਪ ਸਿੰਘ ਜੀ ਗੱਲ ਕਰਦੇ ਪਏ ਹਾਂਜੀ ਹਾਂਜੀ ਭਾਅ ਜੀ ਮੇਰਾ ਨਾ ਔਡਰ ਹੈਗਾ ਸੀ ਤੁਹਾਡੇ ਕੋਲ ਸਵੀਗੀ ਤੋਂ ਮੈਂ ਔਡਰ ਕੀਤਾ ਸੀ ਤੁਹਾਡੇ ਕੋਲ ਔਡਰ ਹੋਣਾ ਮੇਰਾ ਦੋ ਬਰਗਰ ਹੈਗੇ ਸੀ ਫਰੈਂਚ ਫਰਾਈਜ਼ ਹੈਗੇ ਸੀ ਅਤੇ ਇੱਕ ਕੋਲਡਰਿੰਕ ਹੈਗੀ ਸੀ ਅਤੇ ਇੱਕ ਲਾਰਜ ਪੀਜ਼ਾ ਹੈਗਾ ਸੀ ਅਤੇ ਭਾਅ ਜੀ ਮੇਰੇ ਕੋਲ ਨਾ ਗਲਤੀ ਨਾ ਮਤਲਬ ਅਡਰੈਸ ਮੇਰਾ ਪੁਰਾਣੇ ਮਕਾਨ ਦਾ ਪੈ ਗਿਆ ਜਿੱਥੇ ਪਹਿਲਾਂ ਰਹਿੰਦਾ ਹੁੰਦਾ ਸੀ ਮੈਂ ਉੱਥੋਂ ਦਾ ਨਾ ਪਤਾ ਨਹੀਂ ਕੀ ਸਿਸਟਮ ਹੈਗਾ ਹੈ ਸਵੀਗੀ ਦਾ ਉਹ ਮੇਰਾ ਉਹੀ ਅਡਰੈਸ ਚੁੱਕ ਲਿਆ ਇਹਨਾਂ ਨੇ ਅਤੇ ਮੈਂ ਹੁਣੇ ਚੈੱਕ ਕੀਤਾ ਇੱਥੋਂ ਡਿਲੀਵਰੀ ਐਪ 'ਤੇ ਦੇਖਿਆ ਤੁਹਾਡੀ ਲੋਕੇਸ਼ਨ ਉੱਧਰ ਦੇ ਪਾਸੇ ਜਾਣ ਡੀ ਸੀ ਕਿ ਤੁਸੀਂ ਰੋਂਗ ਸਾਈਡ 'ਤੇ ਜਾਣ ਡੇ ਮੈਨੂੰ ਤੁਹਾਡੀ ਟਰੈਕ ਕਰ ਲਈ ਨਾ ਮੈਂ ਔਨਲਾਈਨ ਲੋਕੇਸ਼ਨ ਸਵੀਗੀ ਐਪ 'ਤੇ ਹਾਂਜੀ ਅਤੇ ਹਾਂਜੀ ਹਾਂਜੀ ਭਾਅ ਜੀ ਅਤੇ ਹੁਣ ਮੇਰਾ ਨਵੇਂ ਅਡਰੈਸ ਤੁਸੀਂ ਪੁਰਾਣਾ ਅਡਰੈਸ ਮੇਰਾ ਇਹ ਹੈਗਾ ਸੀ ਮਕਾਨ ਨੰਬਰ ਅੱਠ ਗਲੀ ਨੰਬਰ ਇੱਕ ਹੈਗੀ ਸ਼ੇਰ ਸ਼ਾਹ ਸੂਰੀ ਰੋਡ ਛਿਆਟਾ ਇਹ ਹੈਗਾ ਹੈ ਨਾ ਮੇਰਾ ਪੁਰਾਣਾ ਅਡਰੈਸ ਤੁਹਾਨੂੰ ਜਿਹੜਾ ਸ਼ੋ ਹੋ ਰਿਹਾ ਤੁਹਾਡੀ ਐਪ 'ਤੇ ਹਾਂਜੀ ਜੀ ਇਹ ਅਡਰੈਸ ਨਹੀਂ ਹੈਗਾ ਮੇਰਾ ਹੁਣ ਤੁਹਾਨੂੰ ਮੈਂ ਰਿਕਐਸਟ ਹੈਗੀ ਮੇਰੀ ਤੁਹਾਨੂੰ ਤੁਹਾਡੇ ਅੱਗੇ ਕਿਉਂਕਿ ਤੁਸੀਂ ਨਵੇਂ ਅਡਰੈਸ ਲਿਖੋਂਗੇ ਮੇਰਾ ਨੋਟ ਕਰ ਲਿਓ ਮਾੜਾ ਜਿਹਾ ਅਡਰੈਸ ਹਾਂਜੀ ਲਿਖਿਓ ਮਾੜਾ ਜਿਹਾ ਅਡਰੈਸ ਲਿਖਿਓ ਸੰਨ ਸਾਹਿਬ ਗੁਰਦੁਆਰਾ ਨੀਅਰ ਤੁਲੀ ਮੈਡੀਕਲ ਸਟੋਰ ਪਤਾ ਤੁਹਾਨੂੰ ਸਰ ਇਹਦਾ ਇਹ ਛਿਹਾਟੇ ਲਾਗੇ ਹੈਗਾ ਉਹਦੇ ਲਾਗੇ ਲਾਗੇ ਸ਼ਾਗੇ ਪੈ ਜਾਂਦਾ ਬਿਲਕੁਲ ਏਰੀਆ ਲਾਗੇ ਹੈਗਾ ਫਾਟਕ ਵਾਲੇ ਪਾਸੇ ਹਾਂਜੀ ਹਾਂਜੀ ਅਤੇ ਹਾਂਜੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਉਸ ਤੋਂ ਬਾਅਦ ਨਾ ਤੁਲੀ ਮੈਡੀਕਲ ਸਟੋਰ ਲਾਗੇ ਤੁਹਾਨੂੰ ਪਤਾ ਲੱਗ ਜੂਗਾ ਠੀਕ ਆ ਨਹੀਂ ਤਾਂ ਮੈਨੂੰ ਕਾਲ ਕਰ ਲਿਓ ਇੱਕ ਵਾਰੀ ਮੈਂ ਤੁਹਾਨੂੰ ਵੈਸੇ ਆਪਣੀ ਵਟਸਐਪ 'ਤੇ ਵੀ ਲੋਕੇਸ਼ਨ ਸੈਂਡ ਕਰ ਦਿੰਦਾ ਇੱਕ ਵਾਰੀ ਅਤੇ ਤੁਸੀਂ ਮੈਨੂੰ ਫੋਨ ਕਰਿਓ ਉੱਥੇ ਆਣ ਕੇ ਠੀਕ ਹੈ ਅਤੇ ਫੋਨ ਕਰ ਦਿਓ ਬਸ ਕੋਈ ਗੱਲ ਨਹੀਂ ਅਰਾਮ ਨਾਲ ਆਇਓ ਠੀਕ ਹੈ ਚਲੋ ਠੀਕ ਹੈ ਭਾਅ ਜੀ ਆ ਜੋ ਵੇਲੇ ਟੈਮ ਸਿਰ ਆ ਜਿਓ